ਹਾਂਜੀ ਮੈਂ ਇੱਕ ਯਾਦਗਾਰ ਚੜ੍ਹਾਈ ਯਾਤਰਾ ਦਾ ਵਰਣਨ ਕਰਨਾ ਚਾਹਵਾਂਗੀ ਅਸੀਂ ਹੇ ਹੇਮਕੁੰਟ ਸਾਹਿਬ ਜੋ ਕਿ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਸਿੱਖਾਂ ਦਸਵੇਂ ਗੁਰੂ ਹਨ ਉਹਨਾਂ ਨੇ ਤਪ ਕੀਤਾ ਉਹਨਾਂ ਦਾ ਇੱਕ ਤਪ ਅਸਥਾਨ ਹੈ ਉੱਥੇ ਗਏ ਸੀ ਅਤੇ ਉਹ ਇੱਕ ਚੜ੍ਹਾਈ ਯਾਤਰਾ ਹੀ ਕਹ ਕਹਾਂਗੇ ਉਸਨੂੰ ਕਿਉਂਕਿ ਉੱਥੇ ਦੇ ਬਹੁਤ ਲੰਬੀ ਚੜ੍ਹਾਈ ਹੈ ਜਿਸਨੂੰ ਕਿ ਸਾਹਸ ਦੇ ਨਾਲ ਹੀ ਚੜ੍ਹਿਆ ਜਾ ਸਕਦਾ ਹੈ ਪਹਿਲਾਂ ਤਾਂ ਮੇਰੇ ਅੰਦਰ ਇਹ ਇੱਕ ਡਰ ਸੀ ਕਿ ਹਾਂ ਉਹ ਚੜ੍ਹਾਈ ਬਹੁਤ ਜ਼ਿਆਦਾ ਹੈ ਅਤੇ ਉੱਥੇ ਬਹੁਤ ਸਾਰੀਆਂ ਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਜਿਸ ਦੇ ਕਰਕੇ ਮਨ ਦੇ ਵਿੱਚ ਇੱਕ ਡਰ ਬਣਿਆ ਰਹਿੰਦਾ ਹੈ ਪਰੰਤੂ ਬਹੁਤ ਸਾਰੇ ਬਜ਼ੁਰਗ ਹੈ ਜਿਹੜੇ ਉਹ ਵੀ ਉੱਥੇ ਜਾਣ ਦੇ ਲਈ ਬਹੁਤ ਉਤਸੁਕ ਹੈ ਉਹ ਵੀ ਚੜ੍ਹਾਈ ਚੜ੍ਹ ਕੇ ਗੁਰ ਗੁਰਦੁਆਰਾ ਸਾਹਿਬ ਜਾਂਦੇ ਹਨ ਦਰਸ਼ਨ ਕਰਦੇ ਹਨ ਸੇਵਾ ਕਰਦੇ ਹਨ ਇਸ ਚੀਜ਼ ਨੇ ਮੈਨੂੰ ਵੀ ਮੇਰਾ ਜਿਹੜਾ ਡਰ ਹੈ ਉਸਨੂੰ ਕੁਝ ਘੱਟ ਕਰਿਆ ਅਤੇ ਅਸੀਂ ਵੀ ਹੇਮਕੁੰਟ ਸਾਹਿਬ ਜਾਣ ਬਾਰੇ ਸੋਚਿਆ ਅਤੇ ਅਸੀਂ ਫਿਰ ਗਏ ਚੜ੍ਹਾਈ ਚੜ੍ਹੀ ਪੂਰੇ ਸਾਹਸ ਦੇ ਨਾਲ ਹਾਂਜੀ ਬੰਦੇ ਨੂੰ ਕੁਝ ਔਖਿਆਈਆਂ ਆਉਂਦੀਆਂ ਪ੍ਰੰਤ ਪਰ ਸਾਹਸ ਦੇ ਨਾਲ ਬੰਦਾ ਚੜ੍ਹਦਾ ਜਾਵੇ ਚੜ੍ਹਦਾ ਜਾਵੇ ਅਤੇ ਉੱਥੇ ਪਹੁੰਚ ਹੀ ਜਾਂਦਾ ਹੈ ਅਤੇ ਅਸੀਂ ਵੀ ਪਹੁੰਚ ਗਏ ਸਾਹਸ ਦੇ ਨਾਲ ਚੜ੍ਹ ਕੇ ਚੜ੍ਹਾਈ ਅਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਉੱਥੇ ਬੈਠ ਕੇ ਪਾਠ ਕੀਤਾ ਮਨ ਨੂੰ ਬਹੁਤ ਸਕੂਨ ਸ਼ਾਂਤੀ ਮਿਲੀ ਅਤੇ ਆਸ ਪਾਸ ਬਹੁਤ ਸਾਰਾ ਸੋਹਣਾ ਦ੍ਰਿਸ਼ ਹੈ ਜਿਹੜਾ ਉੱਥੇ ਦੇਖਣ ਨੂੰ ਮਿਲਦਾ ਹੈ ਮਨ ਨੂੰ ਬਹੁਤ ਸਕੂਨ ਮਿਲਦਾ ਇੱਕ ਵਧੀਆ ਅਨੁਭਵ ਰਿਹਾ